ਭਾਰਤ ਇੱਕ ਵਿਕਸਿਤ ਦੇਸ਼ ਹੈ ਇੱਥੇ ਹਰ ਤਰ੍ਹਾਂ ਦੇ ਸਰਕਾਰੀ ਅਤੇ ਪ੍ਰਾਈਵੇਟ ਸਿਹਤ ਸੰਸਥਾਵਾਂ ਹਨ ਇਹ ਸਿਹਤ ਅਦਾਰੇ ਛੋਟੇ ਵੀ ਹਨ ਅਤੇ ਵੱਡੇ ਵੀ ਹਨ ਪ੍ਰਾਈਵੇਟ ਵੀ ਹਨ ਅਤੇ ਸਰਕਾਰੀ ਵੀ ਹਨ ਇੱਥੇ ਹਰ ਵਰਗ ਦੇ ਲੋਕਾਂ ਲਈ ਹਰ ਤਰ੍ਹਾਂ ਦਾ ਇਲਾਜ ਮੌਜੂਦ ਹੈ ਪਹਿਲੇ ਸਮਿਆਂ ਵਿੱਚ ਇੰਨੀਆਂ ਸਿਹਤ ਸੰਸਥਾਵਾਂ ਨਹੀਂ ਸਨ ਸਰਕਾਰੀ ਹਸਪਤਾਲ ਬਹੁਤ ਦੂਰ ਦੂਰ ਹੁੰਦੇ ਸਨ ਅਤੇ ਇੰਨੀਆਂ ਸਹੂਲਤਾਂ ਵੀ ਮੌਜੂਦ ਨਹੀਂ ਸਨ ਜਿੰਨੀਆਂ ਅੱਜ ਦੇ ਆਧੁਨਿਕ ਸਮੇਂ ਦੇ ਵਿੱਚ ਹਨ ਤਕਨਾਲੋਜੀ ਨੇ ਸਿਹਤ ਸੈਕਟਰ ਵਿੱਚ ਆਪਣਾ ਬਹੁਤ ਵੱਡਾ ਰੋਲ ਅਦਾ ਕੀਤਾ ਹੈ ਕਿਉਂਕਿ ਅੱਜ ਦੇ ਸਮੇਂ ਮਸ਼ੀਨਾਂ ਲੈਬਾਂ ਆਦਿ ਮੌਜੂਦ ਹਨ ਜਿਨ੍ਹਾਂ ਦੁਆਰਾ ਹਰ ਤਰ੍ਹਾਂ ਦੀ ਬਿਮਾਰੀਆਂ ਨੂੰ ਛੇਤੀ ਜਾਣਿਆ ਜਾ ਸਕਦਾ ਹੈ ਕੁਝ ਸਰਕਾਰੀ ਅਦਾਰਿਆਂ ਵਿੱਚ ਡਾਕਟਰੀ ਸੇਵਾਵਾਂ ਸਸਤੀਆਂ ਹਨ ਪ੍ਰਾਈਵੇਟ ਅਦਾਰਿਆਂ ਵਿੱਚ ਪ੍ਰਸ਼ਾਸ਼ਨ ਵੱਲੋਂ ਸਿਹਤ ਕਾਰਡ ਬਣਾਏ ਗਏ ਹਨ ਤਾਂ ਜੋ ਇਨ੍ਹਾਂ ਕਾਰਡਾਂ ਨੂੰ ਦਿਖਾ ਕੇ ਲੋਕ ਆਪਣਾ ਸਸਤਾ ਇਲਾਜ ਕਰਾ ਸਕਣ ਕੋਵਿਡ ਮਹਾਂਮਾਰੀ ਵਿੱਚ ਪ੍ਰਸ਼ਾਸ਼ਨ ਵੱਲੋਂ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਗਈ ਸੀ ਅਤੇ ਇਸ ਮਹਾਂਮਾਰੀ ਤੋਂ ਬਚਣ ਲਈ ਸ਼ੋਸ਼ਲ ਮੀਡੀਆ ਰਾਹੀਂ ਵੀ ਪ੍ਰਸ਼ਾਸ਼ਨ ਨੇ ਜਾਣਕਾਰੀ ਦਿੱਤੀ ਸੀ ਸਾਡੇ ਇਲਾਕੇ ਵਿੱਚ ਸਰਕਾਰੀ ਹਸਪਤਾਲ ਦੇ ਨਾਲ ਨਾਲ ਪਿੰਡਾਂ ਵਿੱਚ ਛੋਟੇ ਛੋਟੇ ਸਿਹਤ ਕਲੀਨਿਕ ਖੋਲ੍ਹਣੇ ਚਾਹੀਦੇ ਹਨ ਅਤੇ ਸਮੇਂ ਸਮੇਂ 'ਤੇ ਬਿਮਾਰੀਆਂ ਤੋਂ ਬਚਣ ਲਈ ਸੈਮੀਨਾਰ ਲਗਾ ਕੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ